ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਵਿੱਚ ਕਾਫੀ ਅੰਤਰ ਹਨ ਜਿਵੇਂ ਕਿ ਉੱਤਰੀ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਸਟੇਟ ਹੈ ਔਰ ਨਾਲ ਲੱਗਦਾ ਜੰਮੂ ਕਸ਼ਮੀਰ ਦਾ ਇਲਾਕਾ ਹੈ ਉੱਤਰੀ ਭਾਰਤ ਦੇ ਵਿੱਚ ਕਾਫੀ ਇਲਾਕਾ ਜੋ ਕਿ ਪਹਾੜੀ ਇਲਾਕਾ ਹੈ ਔਰ ਉਸ ਤੋਂ ਬਾਅਦ ਮੌਸਮ ਦਾ ਬੁਹਤ ਜ਼ਿਆਦਾ ਫਰਕ ਹੈ ਔਰ ਦੱਖਣੀ ਇਲਾਕੇ ਦੇ ਅੰਦਰ ਕਾਫੀ ਜੋ ਜ਼ਮੀਨ ਦੀ ਬਣਤਰ ਹੈ ਉਹ ਅਲੱਗ ਹੈ ਔਰ ਉਸ ਤੋਂ ਬਾਅਦ ਮੌਸਮ ਦਾ ਬਹੁਤ ਜ਼ਿਆਦਾ ਫਰਕ ਹੈ ਉੱਤਰ ਭਾਰਤ ਦੇ ਵਿੱਚ ਤਕਰੀਬਨ ਤਕਰੀਬਨ ਚਾਰ ਜੋ ਸਾਡੇ ਇੱਕ ਸਾਲ ਦੇ ਦੌਰਾਨ ਮੌਸਮ ਦੀਆਂ ਤਬਦੀਲੀਆਂ ਸਾਰੀਆਂ ਆਉਂਦੀਆਂ ਨੇ ਲੇਕਿਨ ਦੱਖਣੀ ਭਾਰਤ ਦੇ ਅੰਦਰ ਕੁਝ ਇਲਾਕੇ ਐਸੇ ਹਨ ਜਿੱਥੇ ਲਗਾਤਾਰ ਹੀ ਗਰਮੀ ਪੈਂਦੀ ਹੈ ਠੰਡ ਬਹੁਤ ਘੱਟ ਹੈ ਲੇਕਿਨ ਉੱਤਰ ਭਾਰਤ ਦੇ ਵਿੱਚ ਤਕਰੀਬਨ ਗਰਮੀ ਵੀ ਪੈਂਦੀ ਹੈ ਔਰ ਠੰਡ ਵੀ ਪੈਂਦੀ ਹੈ ਬਰਸਾਤ ਵੀ ਪੈਂਦੀ ਹੈ ਔਰ ਦੱਖਣੀ ਇਲਾਕੇ ਦੇ ਵਿੱਚ ਕੁਛ ਥਾਵਾਂ ਸਾਊਥ ਸਾਇਡ ਇਸ ਤਰੀਕੇ ਦੀਆਂ ਹਨ ਜਿੱਥੇ ਲਗਾਤਾਰ ਬਾਰਿਸ਼ ਹੁੰਦੀ ਰਹਿੰਦੀ ਹੈ ਔਰ ਇਸ ਤੋਂ ਬਾਅਦ ਗੱਲ ਕਰੀਏ ਪਹਿਰਾਵੇ ਦੀ ਉੱਤਰੀ ਭਾਰਤ ਦੇ ਵਿੱਚ ਤਕਰੀਬਨ ਹਰ ਪ੍ਰਕਾਰ ਦਾ ਬੰਦਾ ਹਰ ਪਹਿਰਾਵੇ ਨਾਲ ਦੇਖਿਆ ਜਾਂਦਾ ਹੈ ਔਰ ਬਲਕਿ ਸਾਊਥ ਦੇ ਵਿੱਚ ਤਕਰੀਬਨ ਤਕਰੀਬਨ ਇੱਕੋਂ ਹੀ ਪ੍ਰਕਾਰ ਦਾ ਜੋ ਪਹਿਰਾਵਾ ਹੈ ਉਹ ਪਾਇਆ ਜਾਂਦਾ ਹੈ ਰਹੀ ਗੱਲ ਖਾਣ ਪਾਣ ਦੀ ਉੱਤਰੀ ਭਾਰਤ ਦੇ ਵਿੱਚ ਜੋ ਕਿ ਪੰਜਾਬ ਹੈ ਪੰਜਾਬ ਦੇ ਵਿੱਚ ਹਰ ਪ੍ਰਕਾਰ ਦਾ ਅੱਜ ਕੱਲ੍ਹ ਤੁਹਾਨੂੰ ਖਾਣਾ ਖਾਣ ਨੂੰ ਮਿਲ ਜਾਵੇਗਾ ਔਰ ਦੱਖਣ ਦੇ ਵਿੱਚ ਤਕਰੀਬਨ ਜੋ ਕਿ ਜ਼ਿਆਦਾਤਰ ਨਾਰੀਅਲ ਦੀ ਖੇਤੀ ਹੋਰ ਕੇਲੇ ਦੀ ਖੇਤੀ ਹੋਰ ਹੁੰਦੀਆਂ ਅਲੱਗ ਪ੍ਰਕਾਰ ਦੀਆਂ ਔਰ ਉਧਰ ਦੋ ਖਾਣਾ ਹੈ ਥੋੜ੍ਹਾ ਅਲੱਗ ਕਿਸਮ ਦਾ ਹੈ ਔਰ ਲੋਕਾਂ ਦੀ ਬਣਤਰ ਔਰ ਸਿਹਤ ਪੱਖੋਂ ਵੀ ਕਾਫ਼ੀ ਅੰਤਰ ਹੈ ਔਰ ਉਸ ਤੋਂ ਬਾਅਦ ਜੋ ਭਾਸ਼ਾ ਹੈ ਭਾਸ਼ਾ ਵੀ ਅਲੱਗ ਪ੍ਰਕਾਰ ਦੀ ਹੈ ਜਿਵੇਂ ਕਿ ਉੱਤਰੀ ਭਾਰਤ ਵਿੱਚ ਪੰਜਾਬ ਹੈ ਜੰਮੂ ਕਸ਼ਮੀਰ ਹੈ ਹਿਮਾਚਲ ਹੈ ਪੰਜਾਬ ਦੀ ਭਾਸ਼ਾ ਪੰਜਾਬੀ ਹੈ ਹਿਮਾਚਲ ਦੀ ਡੋਗਰੀ ਭਾਸ਼ਾ ਹੈ ਜੰਮੂ ਦੀ ਡੋਗਰੀ ਭਾਸ਼ਾ ਹੈ ਕਸ਼ਮੀਰ ਦੀ ਕਸ਼ਮੀਰੀ ਭਾਸ਼ਾ ਹੈ ਉਸ ਤਰੀਕੇ ਨਾਲ ਸਾਊਥ ਸਾਇਡ ਮਹਾਂਰਾਸ਼ਟਰ ਹੈ ਤੇਲੰਗਾਨਾ ਹੈ ਔਰ ਕਰਨਾਟਕ ਤਾਮਿਲਨਾਡੂ ਹੈ ਇਹਨਾਂ ਵਿੱਚ ਅਲੱਗ ਅਲੱਗ ਪ੍ਰਕਾਰ ਦੀ ਜੋ ਭਾਸ਼ਾ ਬੋਲੀ ਜਾਂਦੀ ਹੈ ਬਾਕੀ ਜੋ ਰਾਜਨੀਤਕ ਹੈ ਰਾਜਨੀਤਕ ਦੇ ਹਿਸਾਬ ਨਾਲ ਵੀ ਇਹ ਅਲੱਗ ਅਲੱਗ ਇਹਨਾਂ ਦਾ ਕਾਰਵਾਈ ਹੈ ਕਿਸ ਕਿਤੇ ਸਰਕਾਰ ਦਾ ਕੀ ਕਾਰਵਾਈ ਹੈ ਸਾਊਥ ਵਿੱਚ ਕੀ ਹੈ ਔਰ ਨੌਰਥ ਦੇ ਵਿੱਚ ਕੀ ਹੈ ਉਸ ਤੋਂ ਬਾਅਦ ਮੌਸਮ ਹੈ ਜੋ ਮੌਸਮ ਹਰ ਪ੍ਰਕਾਰ ਦਾ ਦੋਨਾਂ ਦਾ ਵੱਖਰਾ ਵੱਖਰਾ ਹੈ ਬਾਕੀ ਭੂਗੋਲਿਕ ਸਥਿਤੀ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਪਹਾੜੀ ਹੈ ਔਰ ਸਾਊਥ ਦੇ ਵਿੱਚ ਸਾਨੂੰ ਜ਼ਿਆਦਾਤਰ ਸਮੁੰਦਰੀ ਇਲਾਕੇ ਔਰ ਪੱਧਰੇ ਇਲਾਕੇ ਸਾਨੂੰ ਮਿਲਣਗੇ